ਮੈਂ ਪਿਛਲੇ ਦਿਨੀਂ ਦਿੱਲੀ ਗਈ ਸੀ ਮੈਂ ਅਨੁਭਵ ਕੀਤਾ ਕਿ ਟਰੇਨ ਦੇ ਵਿੱਚ ਬਹੁਤ ਜ਼ਿਆਦਾ ਰਸ਼ ਸੀ ਕਿਉਂਕਿ ਟਰੇਨ ਦੇ ਵਿੱਚ ਜੋ ਬਿਨਾਂ ਬੁਕਿੰਗ ਵਾਲੇ ਸਨ ਉਹ ਵੀ ਉਸੇ ਡੱਬੇ ਦੇ ਵਿੱਚ ਬੈਠੇ ਹੋਏ ਸਨ ਜਦੋਂ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੁਕਿੰਗ ਵਾਲੇ ਡੱਬਿਆਂ ਦੇ ਵਿੱਚ ਸਿਰਫ ਬੁਕਿੰਗ ਵਾਲੇ ਪੈਸੰਜਰਸ ਹੀ ਬਿਠਾਏ ਜਾਣ ਉਹਨਾਂ ਦੀ ਟਰੇਨ ਦੇ ਗੇਟ ਉੱਪਰ ਚੈਕਿੰਗ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਬੁਕਿੰਗ ਕਰਵਾਈ ਹੋਈ ਹੈ ਜਾਂ ਨਹੀਂ ਇਸ ਤਰ੍ਹਾਂ ਇਹ ਹੋਵੇਗਾ ਕਿ ਜੋ ਬੁਕਿੰਗ ਵਾਲੇ ਪੈਸੰਜਰ ਹਨ ਉਹਨਾਂ ਨੂੰ ਸੁਵਿਧਾ ਹੋ ਜਾਏਗੀ ਜੋ ਦੂਸਰੇ ਪੈਸੰਜਰਸ ਆ ਕੇ ਬੁਕਿੰਗ ਵਾਲੀਆਂ ਸੀਟਾਂ 'ਤੇ ਬੈਠ ਜਾਂਦੇ ਹਨ ਅਤੇ ਫਿਰ ਬੁਕਿੰਗ ਕੀਤੇ ਹੋਏ ਪੈਸੰਜਰਸ ਨਾਲ ਲੜਾਈ ਝਗੜਾ ਕਰਦੇ ਹਨ ਕਿ ਅਸੀਂ ਬੈਠੇ ਹੋਏ ਹਾਂ ਸੀਟ 'ਤੇ ਪਰ ਇਸ ਨਾਲ ਦਿੱਕਤ ਹੋ ਜਾਂਦੀ ਹੈ ਅਤੇ ਮੈਂ ਇਹ ਵੀ ਅਨੁਭਵ ਕੀਤਾ ਕਿ ਟਰੇਨ ਦੇ ਵਿੱਚ ਜੋ ਖਾਣਾ ਸਪਲਾਈ ਹੋ ਰਿਹਾ ਹੈ ਉਹ ਬਿਲਕੁਲ ਵੀ ਚੰਗਾ ਨਹੀਂ ਹੈ ਸ਼ੁਕਰ ਹੈ ਅਸੀਂ ਘਰ ਤੋਂ ਆਪਣਾ ਖਾਣਾ ਨਾਲ ਲੈ ਕੇ ਗਏ ਸੀ ਮੇਰਾ ਸੁਝਾਅ ਇਹ ਹੈ ਕਿ ਟਰੇਨ ਦੇ ਵਿੱਚ ਖਾਣਾ ਸਪਲਾਈ ਕਰਨ ਤੋਂ ਪਹਿਲਾਂ ਫੂਡ ਸਪਲਾਈ ਵਾਲਿਆਂ ਵੱਲੋਂ ਚੈਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਹ ਖਾਣਾ ਖਰਾਬ ਵੀ ਹੋ ਸਕਦਾ ਹੈ ਅਤੇ ਜੋ ਪੈਸੰਜਰ ਇਸ ਖਾਣੇ ਨੂੰ ਖਾਣਗੇ ਉਹਨਾਂ ਦੀ ਤਬੀਅਤ ਵੀ ਖਰਾਬ ਹੋ ਸਕਦੀ ਹੈ ਇਸ ਲਈ ਇਹਨਾਂ ਸਾਰੀਆਂ ਗੱਲਾਂ ਦਾ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਹਰ ਪੈਸੰਜਰ ਦਾ ਸਫਰ ਵਧੀਆ ਬਣ ਸਕੇ ਅਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ